ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਸਥਾਨਕ ਭਾਈਚਾਰੇ ਨਾਲ ਜੁੜਿਆ ਹੋਇਆ ਹੈ ਉਸ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਵੀ ਟੈਕਨੋਲੋਜੀ ਬਹੁਤ ਹੀ ਵੱਡੇ ਲੈਵਲ ਤੱਕ ਵੱਧ ਚੁੱਕੀ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਸਭ ਤੋਂ ਮੇਨ ਜਿਹੜਾ ਸਭ ਤੋਂ ਵੱਡਾ ਜੋ ਅੱਜ ਕੱਲ੍ਹ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਹੈ ਉਹ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਹੀ ਲੋਕ ਜੁੜੇ ਹੋਏ ਹਨ ਸੋਸ਼ਲ ਮੀਡੀਆ ਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ ਜੋ ਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਵੀ ਹਰ ਇੱਕ ਇਨਸਾਨ ਨੂੰ ਪਤਾ ਹੈ ਜਿਸ ਵਿੱਚ ਅਸੀਂ ਦੱਸਦੇ ਹਾਂ ਕਿ ਅਗਰ ਕੋਈ ਬਜ਼ੁਰਗ ਆਦਮੀ ਹੈ ਉਸਨੂੰ ਜ਼ਿਆਦਾ ਨੌਲੇਜ ਨਹੀਂ ਹੈ ਕਿਸ ਚੀਜ਼ ਬਾਰੇ ਤਾਂ ਉਹ ਆਪਣੇ ਬੱਚਿਆਂ ਰਾਹੀਂ ਪੁੱਛਦਾ ਹੈ ਕਿ ਮੈਂ ਕਿਵੇਂ ਕਰ ਸਕਦਾ ਹਾਂ ਇਹ ਚੀਜ਼ ਨੂੰ ਕਿਵੇਂ ਪੜ੍ਹ ਸਕਦਾ ਹਾਂ ਇਸ ਕਿਸ ਚੀਜ਼ ਨੂੰ ਕਿਵੇਂ ਸਮਝ ਸਕਦਾ ਹਾਂ ਸਾਡੇ ਭਾਈਚਾਰੇ ਦੇ ਨਾਲ ਟੈਕਨੋਲੋਜੀ ਦਾ ਨਾਲ ਬਹੁਤ ਹੀ ਵੱਡਾ ਮੇਲਜੋਲ ਹੈ ਜਿਸ ਵਿੱਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਇਸ ਬ ਹਰ ਇੱਕ ਬੰਦੇ ਨੂੰ ਇਹ ਪਤਾ ਹੈ ਕਿ ਅਸੀਂ ਸੋਸ਼ਲ ਮੀਡੀਆ ਕਿੱਦਾਂ ਯੂਸ ਕਰਨਾ ਹੈ ਸੋਸ਼ਲ ਮੀਡੀਆ 'ਤੇ ਹਰ ਇੱਕ ਬੰਦਾ ਐਕਟਿਵ ਹੈ ਜਿਸ ਵਿੱਚ ਅਗਰ ਕੋਈ ਕੋਈ ਵੀ ਬੰਦਾ ਕੋਈ ਪੋਸਟ ਸ਼ੇਅਰ ਕਰਦਾ ਹੈ ਅਤੇ ਬਹੁਤ ਸਾਰੇ ਲੋਕ ਉਸਦੇ ਉੱਪਰ ਲਾਈਕ ਸ਼ੇਅਰ ਕਮੈਂਟ ਕਰਦੇ ਹਨ ਜੋ ਕਿ ਸਾਡੇ ਸੋਸ਼ਲ ਮੀਡੀਆ ਅਤੇ ਐਕਟਿਵ ਹੋਣ ਦਾ ਪ੍ਰਤੀਕ ਹੈ